ਭੰਗੜਾ ਸਾਡਾ ਪੰਜਾਬ ਦਾ ਪ੍ਰਮੁੱਖ ਲੋਕ ਨਾਚ ਹੈ ਭੰਗੜਾ ਇਹ ਪੰਜਾਬ ਦਾ ਬਹੁਤ ਵਧੀਆ ਇੱਕ ਐਕਸਰਸਾਈਜ ਵਜੋਂ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਨਾਲ ਸਾਡੀ ਸਰੀਰ ਦੀ ਕਸਰਤ ਵੀ ਹੁੰਦੀ ਆ ਭੰਗੜਾ ਸਾਡੇ ਪੰਜਾਬ ਦੇ ਮੇਲਿਆਂ ਵਿੱਚ ਜਿਵੇਂ ਕਿ ਵਿਸਾਖੀ ਹੋ ਗਿਆ ਦੁਸ਼ਹਿਰਾ ਹੋ ਗਿਆ ਹੋਰ ਸਾਰੇ ਬਹੁਤ ਸਾਰੇ ਮੇਲਿਆਂ ਵਿੱਚ ਇਹ ਭੰਗੜਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਵੀ ਵਿਆਹ ਸ਼ਾਦੀ ਕੋਈ ਵੀ ਵਿਆਹ ਹੋਵੇ ਕੋਈ ਵੀ ਫੰਕਸ਼ਨ ਹੋਵੇ ਭੰਗੜੇ ਤੋਂ ਬਿਨਾਂ ਅਧੂਰਾ ਰਹਿੰਦਾ ਹੈ ਜਿੱਥੇ ਭੰਗੜਾ ਨਾ ਹੋਵੇ ਉੱਥੇ ਤਾਂ ਮਤਲਬ ਕੁਛ ਵੀ ਚੰਗਾ ਨਹੀਂ ਲੱਗਦਾ ਭੰਗੜੇ ਤੋਂ ਬਿਨਾਂ ਤਾਂ ਸਭ ਕੁਝ ਹੀ ਅਧੂਰਾ ਰਹਿ ਜਾਂਦਾ ਹੈ ਸਕੂਲਾਂ ਵਿੱਚ ਵੀ ਜਿਆਦਾਤਰ ਭੰਗੜੇ ਨਾਲ ਹੀ ਕਿਸੇ ਵੀ ਫੰਕਸ਼ਨ ਦੀ ਸ਼ੁਰੂਆਤ ਹੁੰਦੀ ਐ ਜਾਂ ਐਂਡ ਹੁੰਦਾ ਤਾਂ ਭੰਗੜੇ ਨਾਲ ਹੀ ਹੁੰਦਾ ਹੈ ਕਿਉਂਕਿ ਭੰਗੜਾ ਹੀ ਇੱਕ ਪੰਜਾਬ ਦਾ ਮਹੱਤਵਪੂਰਨ ਨਾਚ ਹੈ ਇਸ ਦੇ ਵਿੱਚ ਇਹਨਾਂ ਦਾ ਪਹਿਰਾਵਾ ਵੀ ਪੰਜਾਬੀ ਪੰਜਾਬ ਦੇ ਤੌਰ ਤੇ ਹੀ ਹੁੰਦਾ ਹੈ ਜਿੱਦਾਂ ਕਿ ਪੰਜਾਬੀਆਂ ਦਾ ਪਹਿਰਾਵਾ ਹੁੰਦਾ ਤਾਂ ਬਹੁਤ ਵਧੀਆ ਪਹਿਰਾਵਾ ਲੜਕੀਆਂ ਦਾ ਪਹਿਰਾਵਾ ਸਲਵਾਰ ਸੂਟ ਲੜਕਿਆਂ ਦਾ ਪਹਿਰਾਵਾ ਕੁੜਤਾ ਪਜ਼ਾਮਾ ਜਾਂ ਪੱਗ ਹੁੰਦੀ ਹੈ